ਗਾਇਕੀ ਦਾ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ ਰੋਜ਼ਾਨਾ ਗਾਇਕੀ ਦਾ ਅਭਿਆਸ ਹਾਰਮੋਨੀਅਮ ਦੇ ਨਾਲ ਕੀਤਾ ਜਾ ਸਕਦਾ ਹੈ ਅਭਿਆਸ ਕਰਨ ਵੇਲੇ ਅਲੱਗ ਅਲੱਗ ਸਰਗਮਾਂ ਦਾ ਅਭਿਆਸ ਕੀਤਾ ਜਾਂਦਾ ਹੈ ਇਸ ਵਿੱਚ ਇਕੱਲੇ ਇਕੱਲੇ ਸੁਰ ਉੱਤੇ ਜਿੰਨਾ ਵੱਧ ਤੋਂ ਵੱਧ ਸਮਾਂ ਟਿਕਿਆ ਜਾ ਸਕੇ ਉਸ ਸੁਰ 'ਤੇ ਟਿਕਣਾ ਚਾਹੀਦਾ ਹੈ ਇਸ ਦੇ ਨਾਲ ਸਾਡਾ ਗਲਾ ਅਤੇ ਸੁਰ ਪੱਕੇ ਹੁੰਦੇ ਹਨ ਅਤੇ ਅਸੀਂ ਵੱਧ ਤੋਂ ਵੱਧ ਸਮਾਂ ਗਾ ਸਕਦੇ ਹਾਂ ਜਿਸ ਨੂੰ ਕਿ ਸਟੈਮੀਨਾ ਵਧਾਉਣਾ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਗਰਮ ਪਾਣੀ ਦੇ ਗਰਾਰੇ ਕਰਨੇ ਚਾਹੀਦੇ ਹਨ ਜਿਸ ਨਾਲ ਗਲਾ ਸਾਫ ਰਹਿੰਦਾ ਹੈ ਅਤੇ ਗਾਉਣ ਵਿੱਚ ਦਿੱਕਤ ਨਹੀਂ ਆਉਂਦੀ ਇਸ ਤੋਂ ਇਲਾਵਾ ਬਾਹਰ ਦਾ ਜੰਕ ਫੂਡ ਅਤੇ ਤਲਿਆ ਹੋਇਆ ਸਮਾਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਗਲੇ ਦੀ ਹਾਲਤ ਸਹੀ ਰਹੇ ਗਾਇਕੀ ਦੇ ਵਿੱਚ ਮੈਨੂੰ ਮੁੱਖ ਤੌਰ 'ਤੇ ਉੱਚੇ ਸੁਰ ਦਾ ਅਭਿਆਸ ਕਰਨਾ ਮੁਸ਼ਕਲ ਲੱਗਦਾ ਹੈ ਕਿਉਂਕਿ ਉਸ 'ਤੇ ਟਿਕਣਾ ਥੋੜ੍ਹਾ ਔਖਾ ਹੁੰਦਾ ਹੈ ਪ੍ਰੰਤੂ ਲਗਾਤਾਰ ਅਭਿਆਸ ਦੇ ਨਾਲ ਅਸੀਂ ਇਸ ਔਕੜ ਨੂੰ ਵੀ ਪਾਰ ਕਰ ਸਕਦੇ ਹਾਂ